ਹੈਲੋ ਹਾਂਜੀ ਹਾਂਜੀ ਸਸ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਭੈਣ ਜੀ ਅਸੀਂ ਤਾਂ ਮਤਲਬ ਸਮਾਨ ਜਿਹੜੀ ਡੇਅਰੀ ਦਿੰਦੀ ਜਿਸ ਤੋਂ ਲੈਂਦੇ ਆ ਉਹ ਤਾਂ ਸਾਡੇ ਲਾਗੇ ਡੇਅਰੀ ਸਲਾਮਾਵਾਦ ਲਾਗੇ ਦੀ ਡੇਅਰੀ ਹੈ ਨਾ ਉੱਥੋਂ ਅਸੀਂ ਸਾਰਾ ਸਮਾਨ ਲੈਂਦੇ ਹਾਂ ਦੁੱਧ ਦਹੀਂ ਦਾ ਹਾਂਜੀ ਪਨੀਰ ਵਗੈਰਾ ਹਾਂਜੀ ਉਨ੍ਹਾਂ ਦਾ ਮਤਲਬ ਨਹੀਂ ਸਮਾਨ ਵਧੀਆ ਕਵਾਲਟੀ ਵਧੀਆ ਹੁੰਦੀ ਹੈ ਉਹਨਾਂ ਦੀ ਤੁਸੀਂ ਇੱਕ ਵਾਰੀ ਜਾ ਕੇ ਵਿਜਿਟ ਕਰਕੇ ਦੇਖੋ ਅਤੇ ਹਾਂਜੀ ਨਹੀਂ ਨਹੀਂ ਵਧੀਆ ਆਉਂਦੇ ਹੈ ਹੋਰ ਵੀ ਇੱਕ ਦੋ ਡੇਅਰੀ ਹੈਗੀ ਗੁਰਦਾਸਪੁਰ 'ਚ ਇੱਕ ਤਾਂ ਉੱਥੇ ਚੱਲ ਜਾਉ ਹਨੂਮਾਨ ਚੌਂਕ ਦੇ ਬਾਹਰ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਵੀ ਲਿਆਉਂਦੇ ਹਾਂ ਮਤਲਬ ਉੱਥੋਂ ਵੀ ਲਿਆਉਂਦੇ ਹਾਂ ਕਈ ਵਾਰੀ ਉੱਥੋਂ ਨਾ ਸਮਾਨ ਮਿਲੇ ਤਾਂ ਹਨੂੰਮਾਨ ਚੌਂਕ ਵਾਲੀ ਸਾਈਡ ਹੈ ਨਾ ਵੀ ਮਾਰਟ ਉਹਦੇ ਮਤਲਬ ਨੀਚੇ ਹੀ ਹੈ ਉੱਥੇ ਉੱਧਰਲੀ ਸਾਈਡ ਹੀ ਹਾਂਜੀ ਸਰਪੰਚ ਦੀ ਡੇਅਰੀ ਹਾਂਜੀ ਉ ਉਹਦੇ ਕੋਲ ਚਲ ਜਿਓ ਹਾਂਜੀ ਕੋਈ ਗੱਲ ਨਹੀਂ ਲੈ ਲਉ ਜਾ ਕੇ